ਆਵਾਜਾਈ ਦੇ ਬਹੁਤ ਸਾਧਨ ਹਨ ਜਿਹਨਾਂ ਦੇ ਵਿੱਚ ਤਾਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਤਾਂਗਾ ਫੇਮਸ ਸੀ ਮਸ਼ਹੂਰ ਸੀ ਪਰ ਹੁਣ ਉਸ ਤੋਂ ਬਾਅਦ ਸਾਡੇ ਕੋਲ ਆਟੋ ਆ ਗਏ ਨੇ ਰਿਕਸ਼ੇ ਆ ਗਏ ਨੇ ਬੱਸ ਆ ਗਈ ਹੈ ਬੱਸਾਂ ਹਨ ਅਤੇ ਸਾਡੇ ਆਪਣੇ ਸਕੂਟਰ ਹਨ ਕਾਰਾਂ ਹਨ ਪਰ ਜੋ ਆਪਣੀ ਯਾਤਰਾ ਦੇ ਵਿੱਚ ਮੈਂ ਵਰਤਿਆ ਹੈ ਜ਼ਿਆਦਾ ਕਿਉਂਕਿ ਮੇਰੀ ਜੋਬ ਬਾਹਰ ਹੋਣ ਕਰਕੇ ਮੈਨੂੰ ਬੱਸ 'ਤੇ ਮੈਂ ਯਾਤਰਾ ਬਹੁਤ ਜ਼ਿਆਦਾ ਕੀਤੀ ਹੈ ਤਾਂ ਉਸ ਦੇ ਵਿੱਚ ਮੈਨੂੰ ਇੱਕ ਮੈਂ ਤੁਹਾਡੇ ਨਾਲ ਆਪਣੀ ਇੱਕ ਯਾਦ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਕਿੰਨਾਂ ਵਧੀਆ ਲੱਗਿਆ ਮੈਨੂੰ ਉਹ ਪਲ ਕਿ ਮੈਂ ਸਾਹਮਣੇ ਦੇਖ ਰਹੀ ਸੀ ਕਿ ਇੱਕ ਬਜ਼ੁਰਗ ਔਰਤ ਜਦੋਂ ਬੱਸ ਦੇ ਵਿੱਚ ਚੜ੍ਹੀ ਸੀ ਤਾਂ ਬੜੀ ਹਫੀ ਹੋਈ ਲੱਗ ਰਹੀ ਸੀ ਅਤੇ ਉਦੋਂ ਮੈਂ ਸੋਚ ਰਹੀ ਸੀ ਕਿ ਹੁਣ ਇਹ ਜਦੋਂ ਬਜ਼ੁਰਗ ਔਰਤ ਚੜ੍ਹੀ ਹੈ ਅਤੇ ਉਹਨੂੰ ਕੌਣ ਸੀਟ ਆਪਣੀ ਦਏਗਾ ਅਤੇ ਮੈਂ ਬੜੀ ਹੈਰਾਨ ਹੋਈ ਕਿ ਇੱਕ ਉਸੇ ਹੀ ਏਜ ਦੀ ਇੱਕ ਔਰਤ ਉਸ ਨੂੰ ਸ਼ਾਇਦ ਲੱਗਿਆ ਕਿ ਕਿਸ ਤਰ੍ਹਾਂ ਇਹ ਬਜ਼ੁਰਗੀ ਦੀ ਅਵਸਥਾ ਨੂੰ ਦੇ ਵਿੱਚੋਂ ਲੰਘ ਰਹੀ ਹੈ ਅਤੇ ਉਸੇ ਅਵਸਥਾ ਨੂੰ ਉਸਨੇ ਉਹਦੀ ਸਾਂਝ ਨੂੰ ਜਾਣਦਿਆਂ ਹੋਇਆ ਆਪਣੀ ਸੀਟ ਖਾਲੀ ਕਰਕੇ ਉਸਨੇ ਉਸਨੂੰ ਦੇ ਦਿੱਤੀ ਅਤੇ ਮੈਨੂੰ ਬਹੁਤ ਚੰਗਾ ਲੱਗਿਆ